ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂ ਭਾਅ ਜੀ ਅਸੀਂ ਤੁਹਾਡੀ ਗਲੀ 'ਚ ਨਾ ਨਵਾਂ ਇੱਥੇ ਮਕਾਨ ਲਿੱਤਾ ਹੈ ਤੁਹਾਡੇ ਘਰ ਤੋਂ ਤਿੰਨ ਚਾਰ ਘਰ ਪਹਿਲਾਂ ਉਹ ਭੈਣ ਜੀ ਮੈਨੂੰ ਮਿਲੇ ਸੀ ਰਸਤੇ ਵਿੱਚ ਤਾਂ ਕਰਕੇ ਮੈਂ ਤੁਹਾਨੂੰ ਰਿੰਗ ਕਰਦੀ ਪਈ ਹਾਂ ਹਾਂਜੀ ਅਤੇ ਮੈਂ ਕੱਲ੍ਹ ਮੈਂ ਲੁਧਿਆਣੇ ਜਾਣਾ ਸੀ ਅਤੇ ਮੈਨੂੰ ਇੱਥੋ ਦਾ ਪ ਏਰੀਆ ਦਾ ਕੋਈ ਪਤਾ ਹੀ ਨਹੀਂ ਕੁਛ ਵੀ ਕਿ ਕਿੱਥੇ ਕਿਸ ਤਰ੍ਹਾਂ ਬੱਸ ਸਟੈਂਡ ਕਿੱਥੇ ਕੁ ਹੈ ਸਟੇਸ਼ਨ ਕਿੱਥੇ ਹਜੇ ਪਤਾ ਨਹੀਂ ਸਿੱਧੀ ਬੱਸ ਮਿਲੇਗੀ ਜਿਹੜੀ ਸਰਵਿਸ ਠੀਕ ਹੀ ਹੈ ਉਹਦੇ ਪੁੱਛਣਾ ਕੀ

ਨਹੀਂ ਮੈਂ ਮੈਂ ਸਿਰਫ ਲੁਧਿਆਣੇ ਤੱਕ ਹੀ ਜਾਣਾ ਹੈ ਅਤੇ ਹਾਂਜੀ ਹਾਂਜੀ ਫਿਰ ਬੱਸ ਸਵੇਰੇ ਮਿਲ ਜੇਗੀ ਇੱਥੋਂ ਠੀਕ ਹੈ ਜੀ ਪੱਛਚਿਮ ਐਕਪ੍ਰੈੱਸ ਤੇ ਉਹ ਟ੍ਰੇਨ ਹੋਏਗੀ ਨਾ ਉਹ ਤਾਂ ਨਹੀਂ ਆ ਸਾਡੇ ਘਰ ਦੇ ਕੋਲੋਂ ਵੀ ਕੋਈ ਸਟੈਂਡ ਨਹੀਂ ਹੈਗਾ ਕਿਤੇ ਕੋਈ ਕੋਮਨ ਪਲੇਸ ਹੋਵੇ ਠੀਕ ਹੈ ਜੀ

ਠੀਕ ਹੈ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਬੱਸ ਆਹਾ ਕਿ ਪ੍ਰੋਬਲਮ ਨਾ ਆਵੇ ਰਸਤੇ ਦੇ ਵਿੱਚ ਕੋਈ ਬੱਚੇ ਛੋਟੇ ਆ ਨਾ ਇਸ ਲਈ ਮੇਰਾ ਛੋਟੇ ਬੱਚਿਆਂ ਨਾਲ ਤਾਂ ਟ੍ਰੇਨ ਹੀ ਸੂਟ ਕਰੇਗੀ ਫਿਰ ਬੱਸ 'ਚ ਤਾਂ ਪ੍ਰੋਬਲਮ ਆ ਜਾਂਦੀ ਹੈ ਕਿੰਨੇ ਕੁ ਪੈਸੇ ਲੈਂਦੇ ਆਟੋ ਵਾਲੇ ਆਟੋ ਵਾਲੇ ਕਿੰਨੇ ਕੁ ਪੈਸੇ ਵੀਹ ਰੁਪਏ ਠੀਕ ਹੈ ਜੀ

ਠੀਕ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ